ਰਸੋਈ ਦੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਬਰਤਨ ਵਰਤਦੇ ਹਾਂ ਸਟੀਲ ਐਲੂਮੀਨੀਅਮ ਪਿੱਤਲ ਮਿੱਟੀ ਨੋਨ ਸਟਿਕੀ ਹਰ ਤਰ੍ਹਾਂ ਦੇ ਬਰਤਨ ਰਸੋਈ ਦੇ ਵਿੱਚ ਵਰਤੇ ਜਾਂਦੇ ਹਨ ਕੁਕਰ ਵਿੱਚ ਅਸੀਂ ਦਾਲ ਸਬਜ਼ੀ ਬਹੁਤ ਜਲਦੀ ਬਣਾ ਲੈਂਦੇ ਹਾਂ ਮਿੱਟੀ ਦੇ ਬਰਤਨ ਵਿੱਚ ਪਾਣੀ ਪੀਣਾ ਬਹੁਤ ਚੰਗਾ ਹੁੰਦਾ ਹੈ ਮਿੱਟੀ ਦੇ ਬਰਤਨ ਵਿੱਚ ਸਾਗ ਦਾਲ ਬਹੁਤ ਹੀ ਸਵਾਦ ਬਣਦੀ ਹੈ ਐਲਮੀਨੀਅਮ ਦੇ ਬਰਤਨ ਬਰ ਐਲਮੀਨੀਅਮ ਦੇ ਬਰਤਨਾਂ ਵਿੱਚ ਜਲਦੀ ਸਬਜ਼ੀ ਬਣ ਜਾਂਦੀ ਹੈ